ਨਗਰ ਕੀਰਤਨ ਜੋ ਪਿੰਡਾਂ ਵਿੱਚ ਜਦੋਂ ਵੀ ਕਿੱਸਾ ਗੁਰੂਆਂ ਦੇ ਸ਼ਹੀਦੀ ਦਿਹਾੜੇ ਜਾਂ ਜਨਮਦਿਨ ਹੁੰਦੇ ਹਨ ਤਾਂ ਉਹਨਾਂ ਉਹਨਾਂ ਉਸ ਦਿਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਜਾਂਦਾ ਗਾ ਨਗਰ ਕੀਰਤਨ ਵਿੱਚ ਇੱਕ ਬਹੁਤ ਵਧੀਆ ਪਾਲਕੀ ਸਜਾਈ ਜਾਂਦੀ ਆ ਜੋ ਕਿ ਸਾਰਾ ਪਿੰਡ ਯੋਗਦਾਨ ਦਿੰਦਾ ਗਾ ਸਾਰੇ ਪਿੰਡ ਦੀ ਜੋ ਸਾਰਾ ਪਿੰਡ ਗੁਰਦੁਆਰਾ ਸਾਹਿਬ ਇਕੱਠਾ ਹੁੰਦਾ ਗਾ ਤਾਂ ਪਿੰਡਾਂ ਵਿੱਚ ਜੋ ਅਲੱਗ ਅਲੱਗ ਸਾਧਨ ਹੁੰਦੇ ਆਗੇ ਉਹ ਆਪ ਕਈ ਲੋਕ ਆਪਣੇ ਸਾਧਨਾਂ 'ਤੇ ਸਾਧਨਾਂ 'ਤੇ ਨਗਰ ਕੀਰਤਨ ਘਰ ਹਰ ਗਲੀ ਹਰ ਮੁਹੱਲੇ ਵਿੱਚ ਜਾਂਦੇ ਹਨ ਨਗਰ ਕੀਰਤਨ ਨਗਰ ਕੀਰਤਨ ਪਿੱਛੇ ਸਾਰਾ ਪਿੰਡ ਸ਼ਰਧਾ ਨਾਲ ਨੰਗੇ ਪੈਰ ਵਗੈਰਾ ਜਾ ਕੇ ਗੁਰੂਆਂ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਸ ਨ ਨਮਸਕਾਰ ਕਰਦਾ ਹੈ ਅਤੇ ਨਗਰ ਕੀਰਤਨ ਨਗਰ ਕੀਰਤਨ ਵਾਲੇ ਦਿਨ ਲੋਕ ਇਕੱਠੇ ਹੋ ਕੇ ਲੰਗਰ ਲਗਾਉਂਦੇ ਹਨ ਚਾਹ ਦਾ ਲੰਗਰ ਜਿਵੇਂ ਜਲੇਬੀਆਂ ਜਲੇਬੀਆਂ ਵਗੈਰਾ ਪਕੌੜੇ ਬਰੈਡ ਐਰਾ ਵਗੈਰਾ ਸਭ ਕੁਝ ਸਭ ਕਾਸੇ ਦਾ ਲੰਗਰ ਲਗਾਇਆ ਜਾਂਦਾ ਗਾ ਨਗਰ ਕੀਰਤਨ 'ਤੇ ਲੋਕ ਆਪਣੀ ਸ਼ਰਧਾ ਮੁਤਾਬਿਕ ਜੋ ਵੀ ਚੜ੍ਹਾਵਾ ਚੜ੍ਹਾਉਣਾ ਹੁੰਦਾ ਹੈਗਾ ਚੜ੍ਹਾਉਂਦੇ ਆ ਪਿੰਡਾਂ ਵਿੱਚ ਜਿਵੇਂ ਲੋਕ ਪੈਸੇ ਪ ਕਈ ਲੋਕ ਪੈਸੇ ਦਾਨ ਦਾਨ ਵਿੱਚ ਦਿੰਦੇ ਹਨ ਕਈ ਲੋਕ ਕਣਕ ਕਈ ਗੁਰੂ ਸਾਹਿਬ ਦੇ ਰੁਮਾਲੇ ਵਗੈਰਾ ਚੜ੍ਹਾ ਕੇ ਚੜ੍ਹਾ ਚੜ੍ਹਾਉਂਦੇ ਹਨ ਨਗਰ ਕੀਰਤਨ ਵਾਲੇ ਦਿਨ ਲੋਕ ਬਹੁਤ ਖੁਸ਼ ਹੁੰਦੇ ਹਨ ਨਗਰ ਕੀਰਤਨ ਦੇ ਪਿੱਛੇ ਪਿੱਛੇ ਪਿੱਛੇ ਪਿੱਛੇ ਸੰਗਤਾਂ ਹੁੰਦੀਆਂ ਹਨ ਉਹ ਪੈਦਲ ਤੁਰ ਰਹੀਆਂ ਹੁੰਦੀਆਂ ਹਨ ਨਗਰ ਕੀਰਤਨ 'ਤੇ ਪੰਜ ਪਿਆਰੇ ਸਜਾਏ ਆ ਸਜਾਏ ਜਾਂਦੇ ਹਨ ਪੰਜ ਪਿਆਰਿਆਂ ਦਾ ਪਹਿਰਾਵਾ ਗੁਰੂ ਸਾਹਿਬਾਨਾਂ ਦੇ ਪਹਿਰਾਵੇ ਨਾਲ ਦਾ ਪਹਿਰਾਵਾ ਪਹਿਨਾਇਆ ਜਾਂਦਾ ਨਗਰ ਕੀਰਤਨ ਇੱਕ ਇੱਕ ਪਰੰਪਰਾ ਪਰੰਪਰਾ ਹੈ ਖਾ ਸ ਹੋਲਾ ਮਹੱਲਾ ਹੋਲੇ ਮਹੱਲੇ ਵਾਲੇ ਦਿਨ ਵੀ ਲੋਕ ਨਗਰ ਕੀਰਤਨ ਵਾਂਗ ਹੀ ਆਪਣੀਆਂ ਤਿਆਰੀਆਂ ਕਰਦੇ ਹਨ ਜਨਵਰੀ ਵਿੱਚ ਗੁਰਪੁਰਬ ਕੱਢਿਆ ਜਾਂਦਾ ਹੈ ਤਾਂ ਗੁਰਪੁਰਬ ਵਾਲੇ ਦਿਨ ਨਗਰ ਨਗਰ ਕੀਰਤਨ ਕੀਤਾ ਜਾਂਦਾ